ਪੰਛੀ ਜਿਹੜੇ ਮਤਲਬ ਇੱਕ ਮਨੁੱਖ ਦੀ ਤਰ੍ਹਾਂ ਹੀ ਪਰਮਾਤਮਾ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਘੜੀ ਹੋਈ ਘਾੜਤ ਹੈ ਪੰਛੀਆਂ ਦੀ ਜਿਹੜੀ ਮਤਲਬ ਚਹਿਚਹਾਹਟ ਜਿਹੜੀ ਹੈ ਉਹ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਦਿੰਦੀ ਹੈ ਜਦੋਂ ਇਹ ਪੰਛੀ ਬੋਲਦੇ ਨੇ ਅੰਤਰ ਅ ਦਰੱਖਤਾਂ 'ਤੇ ਆ ਕੇ ਬੈਠ ਜਾਂਦੇ ਨੇ ਕਿੰਨੀ ਚਹਿਚਹਾਹਟ ਜਿਹੀ ਲਗਾਉਂਦੇ ਨੇ ਮਤਲਬ ਤੁਹਾਨੂੰ ਇਹ ਇਕੱਲਾਪਨ ਜਿਹੜਾ ਉਹ ਮਹਿਸੂਸ ਹੀ ਨਹੀਂ ਹੁੰਦਾ ਅਤੇ ਤੁਸੀਂ ਇਹਨਾਂ ਨੂੰ ਬੜੇ ਹੀ ਸਕੂਨ ਦੇ ਨਾਲ ਦੇਖਦੇ ਹੋ ਅਤੇ ਪੰਛ ਮਤਲਬ ਮੇਰੇ ਇਹਨਾਂ ਨੂੰ ਮੇਰੇ ਅ ਵਿਹੜੇ ਦੇ ਵਿੱਚ ਨਾ ਅ ਦੋ ਤਿੰਨ ਦਰਖਤ ਨੇ ਅਤੇ ਉਸ 'ਤੇ ਆ ਕੇ ਬੈਠ ਜਾਂਦੇ ਹੈ ਤੇ ਮ ਤੋਤੇ ਹੈ ਚਿੜੀਆਂ ਹੈ ਕਾਂ ਹੈ ਅਤੇ ਬਸ ਅਹ ਕਬੂਤਰ ਵੀ ਆ ਜਾਂਦੇ ਨੇ ਕਈ ਵਾਰ ਅਤੇ ਇਹ ਮਤਲਬ ਬੜੀ ਰੌਣਕ ਜਿਹੀ ਲਗਾ ਦਿੰਦੇ ਹੈ ਮੈਂ ਨਾ ਅ ਮਤਲਬ ਪੰਛੀ ਜਿਹੜੇ ਮਤਲਬ ਇਹ ਜਿੰਨਾ ਇਹਨਾਂ ਨੂੰ ਅਸੀਂ ਪਿਆਰ ਕਰਾਂਗੇ ਅਤੇ ਇਹ ਉਨਾ ਹੀ ਨੇੜੇ ਵੀ ਆਉਂਦੇ ਆ ਅਤੇ ਇਹਨਾਂ ਪੰਛੀਆਂ ਦੇ ਜਿਹੜਾ ਮਤਲਵ ਅਸੀਂ ਪਹਿਲਾਂ ਤਾਂ ਜਿਹੜੇ ਪੁਰਾਣੇ ਘਰ ਹੁੰਦੇ ਸੀ ਕੱਚੇ ਘਰ ਉੱਥੇ ਜਿਹੜਾ ਇਹ ਘਰਾਂ ਦੇ ਵਿੱਚ ਆਲ੍ਹਣੇ ਪਾ ਲੈਂਦੇ ਸੀਗੇ ਉੱਥੇ ਰਹਿ ਲੈਂਦੇ ਸੀ ਪਰ ਹੁਣ ਪੱਕੇ ਘਰ ਆ ਗਏ ਹੈ ਅਤੇ ਹੁਣ ਇਹਨਾਂ ਦਾ ਟਿਕਾਣਾ ਜਿਹੜਾ ਆ ਉਹ ਕੋਈ ਪੱਕਾ ਨਹੀਂ ਹੁੰਦਾ ਦਰੱਖਤਾਂ 'ਤੇ ਬਣਾ ਲੈਂਦੇ ਜਾਂ ਜਿੱਥੇ ਵੀ ਇਹਨਾਂ ਨੂੰ ਕਿਤੇ ਜਗ੍ਹਾ ਮਿਲਦੀ ਹੈ ਉੱਥੇ ਆਪਣਾ ਆਲ੍ਹਣਾ ਬਣਾ ਲੈਂਦੇ ਹੈ ਸੋ ਮੈਂ ਅ ਵੀ ਜਿਹੜਾ ਮਤਲਬ ਆਪਣੇ ਘਰ ਦੇ ਵਿੱਚ ਤਾਂ ਹੈ ਜਦੋਂ ਇਹ ਮਤਲਬ ਬੈਠੇ ਹੁੰਦੇ ਹੈ ਅਤੇ ਮੈਂ ਇਹਨਾਂ ਲਈ ਫਿਰ ਜ ਜਦੋਂ ਡਿਊਟੀ 'ਤੇ ਆਉਣਾ ਹੁੰਦਾ ਹੈ ਉਸ ਤੋਂ ਪਹਿਲਾਂ ਮੈਂ ਰੋਟੀ ਬਣਾਉਂਦੀ ਹਾਂ ਅਤੇ ਇਹਨਾਂ ਲਈ ਰੋਟੀ ਬਣਾ ਅ ਬਣਾਈ ਹੁੰਦੀ ਹੈ ਅਤੇ ਇਹਨਾਂ ਨੂੰ ਅੱਧੀ ਲੀ ਪਾ ਦਿੰਦੀ ਆ ਔਰ ਹੁਣ ਇਹ ਯੂਸ ਟੂ ਹੋ ਗਏ ਹੈ ਮਤਲਬ ਕਿ ਇਹਨਾਂ ਨੂੰ ਲੱਗਦਾ ਕਿ ਹਾਂ ਰੋਟੀ ਆਉਣੀ ਆ ਅਤੇ ਪਾਉਣੀ ਆ ਫਿਰ ਟਾਈਮ ਦੇ ਪਾਬੰਦ ਹੋ ਗਏ ਹੋਏ ਆ ਅਤੇ ਹੁਣ ਇਹ ਮਤਲਬ ਵੇਟ ਕਰਦੇ ਹੁੰਦੇ ਕਿ ਕਦੋਂ ਰੋਟੀ ਆਵੇ ਅਤੇ ਆਪਾਂ ਰੋਟੀ ਲਈਏ ਅਤੇ ਸ ਮਤਲਬ ਮੈਨੂੰ ਵੀ ਹੁਣ ਇੱਕ ਜਿਹੜਾ ਹੈ ਉਹ ਰੂਟੀਨ ਜਿਹਾ ਬਣ ਗਿਆ ਹੋਇਆ ਮੇਨਲੀ ਮੈਂ ਇੱਕ ਭਾਂਡੇ ਦੇ ਵਿੱਚ ਜਿਹੜਾ ਪਾਣੀ ਵੀ ਰੱਖਦੀ ਹਾਂ ਅਤੇ ਰੋਟੀ ਵੀ ਪਾ ਦਿੰਦੀ ਹਾਂ ਅਤੇ ਇਹ ਆਪਣਾ ਲੈ ਕੇ ਚਲੇ ਜਾਂਦੇ ਆ